ਮੈਨੂੰ ਬੁਣਾਈ ਅਤੇ ਸਿਲਾਈ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਬਚਪਨ 'ਚ ਬੁਣਾਈ ਅਤੇ ਸਿਲਾਈ ਕਰਦੇ ਆਪਣੀ ਦਾਦੀ ਜੀ ਨੂੰ ਦੇਖਿਆ ਸੀ ਜਿਹਦੇ ਕਰਕੇ ਇਹਨੂੰ ਕਰਨ ਲਈ ਮੇਰੀ ਵੀ ਦਿਲਚਸਪੀ ਬਹੁਤ ਹੀ ਜ਼ਿਆਦਾ ਵੱਧ ਗਈ ਬਚਪਨ ਵਿੱਚ ਮੇਰੀ ਦਾਦੀ ਜੀ ਬੁਣਾਈ ਅਤੇ ਸਿਲਾਈ ਕਰਦੇ ਹੁੰਦੇ ਸਨ ਉਹ ਮੈਨੂੰ ਆਪਣੇ ਨਾਲ ਬਿਠਾਉਂਦੇ ਹੁੰਦੇ ਸੀ ਅਤੇ ਜਿਹਦੇ ਕਰਕੇ ਮੈਂ ਵੀ ਸਵੈਟਰਾਂ ਬੁਣਨੀਆਂ ਸ਼ੁਰੂ ਕੀਤੀਆਂ ਮੈਂ ਵੀ ਸਿਲਾਈ ਕਰਨੀ ਸ਼ੁਰੂ ਕੀਤੀ ਜਿਹਦੇ ਨਾਲ ਮੇਰੀ ਹੋਰ ਇਸ ਕੰਮ ਵਿੱਚ ਦਿਲਚਸਪੀ ਵੱਧ ਗਈ ਬਚਪਨ ਵਿੱਚ ਹੀ ਮੈਨੂੰ ਸ਼ੌਂਕ ਪੈ ਗਿਆ ਕਿ ਮੈਂ ਵੱਡੇ ਹੋ ਕੇ ਇਹੀ ਕੰਮ ਵਿੱਚ ਹੱਥ ਪਾਉਣਾ ਹੈ ਹੁਣ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹਨ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਤਜ਼ਰਬਾ ਹੋ ਗਿਆ ਹੈ ਬੁਣਾਈ ਅਤੇ ਸਿਲਾਈ ਕਰਨਾ ਮੈਨੂੰ ਸ਼ੁਰੂ ਤੋਂ ਹੀ ਪਸੰਦ ਸੀ ਅਤੇ ਦਿਲਚਸਪੀ ਵੀ ਬਹੁਤ ਸੀਗੀ ਅਤੇ ਹੁਣ ਇਹਨੂੰ ਕਰਨ 'ਚ ਮੈਂ ਅੱਗੋਂ ਵੀ ਹੱਥ ਪਾਇਆ ਸੀ ਪਾਇਆ ਹੈ ਅਤੇ ਮੇਰੀ ਇਹ ਦਿਲਚਸਪੀ ਨਾਲ ਹੀ ਮੇਰਾ ਅੱਗੋ ਕਰੀਅਰ ਬਣ ਰਿਹਾ ਹੈ ਹੁਣ ਮੈਨੂੰ ਬਹੁਤ ਹੀ ਸਾਰੇ ਬਹੁਤ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਆਉਂਦੇ ਹਨ ਬਣਾਉਣੇ ਮੈਂ ਸਿਲਾਈ ਵੀ ਕਰਦੀ ਹਾਂ ਅਤੇ ਬੁਣਾਈ ਵੀ ਕਰਦੀ ਹਾਂ ਦਾਦੀ ਜੀ ਕਰਕੇ ਮੇਰੇ ਇਸ ਦਿਲਚਸਪੀ ਨਾਲ ਮੇਰਾ ਕਰੀਅਰ ਬਣ ਰਿਹਾ ਹੈ ਮੇਰਾ ਇਸ ਕੰਮ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹਨ ਮੈਨੂੰ ਕਮਾਈ ਵੀ ਬਹੁਤ ਹੀ ਜ਼ਿਆਦਾ ਹੁੰਦੀ ਹਨ ਅਤੇ ਮੇਰੀ ਪ੍ਰੇਰਨਾ ਵੀ ਹੋਰ ਵੱਧ ਗਈ ਹੈ ਮੇਰਾ ਇਹੀ ਦਿਲ ਹੈ ਕਿ ਮੈਂ ਇਸ ਕੰਮ ਨੂੰ ਜਾਰੀ ਰੱਖਾਂ ਬੁਣਾਈ ਅਤੇ ਸਿਲਾਈ ਕਰਦੇ ਰਵਾਂ ਮੇਰੀ ਦਾਦੀ ਜੀ ਕਰਕੇ ਇਸ ਕੰਮ ਵਿੱਚ ਮੇਰੀ ਦਿਲਚਸਪੀ ਨਾਲ ਮੇਰਾ ਬਹੁਤ ਹੀ ਫਾਇਦਾ ਹੋਇਆ ਹੈ ਅਤੇ ਮੈਨੂੰ ਇਹ ਕੰਮ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹਨ ਦੂਰੋਂ ਦੂਰੋਂ ਲੋਕ ਮੇਰੇ ਕੋਲ ਸਿਲਾਈਆਂ ਕਰਵਾਉਣ ਆਉਂਦੇ ਹਨ ਉਹ ਮੇਕੋ ਸੂਟ ਸਵਾਉਣ ਆਉਂਦੇ ਹਨ ਅਤੇ ਅੱਗੇ ਵੀ ਮੈਂ ਹੋਰ ਇਸ ਕੰਮ ਵਿੱਚ ਹੋਰ ਇਸ ਕੰਮ ਨੂੰ ਵਧਾਉਣਾ ਚਾਹੂੰਗੀ